ਆਟੋ ਟਿਊਨ ਗਾਇਕੀ ਇਕ ਤਕਨੀਕ ਹੈ ਜਿਸ ਵਿੱਚ ਇੱਕ ਸੋਫਟਵੇਅਰ ਦੀ ਵਰਤੋਂ ਕਰਕੇ ਗਾਇਕ ਦੀਆਂ ਜਿਹੜੀਆਂ ਸੁਰਾਂ ਨੂੰ ਸੁਧਾਰਿਆ ਜਾਂਦਾ ਆ ਜਾ ਕਿ ਬਦਲਿਆ ਜਾਂਦਾ ਆ ਇਹ ਜਿਹੜੀ ਤਕਨੀਕ ਆ ਉਹ ਗਾਇਕਾਂ ਦੇ ਬੇਸੁਰੇ ਗੀਤਾਂ ਨੂੰ ਵੀ ਸੁਰ ਦੇ ਵਿੱਚ ਗਾਉਣ ਵਿੱਚ ਮਦਦ ਕਰਦੀ ਆ ਅਤੇ ਅਤੇ ਇਸਦੀ ਵਰਤੋਂ ਕਈ ਵਾਰ ਸੰਗੀਤ ਉਤਪਾਦਨ ਦੇ ਵਿੱਚ ਵੀ ਕੀਤੀ ਜਾਂਦੀ ਆ ਪੰਜਾਬੀ ਸੰਗੀਤ ਵਿੱਚ ਬਹੁਤ ਹੀ ਗਾਇਕ ਜਿਹੜੇ ਆਟੋ ਟਿਊਨ ਦੀ ਵਰਤੋਂ ਕਰਦੇ ਹਨ ਪਰ ਇਹ ਦੱਸਣਾ ਬਹੁਤ ਮੁਸ਼ਕਿਲ ਹੈ ਕਿ ਕਿਹੜੇ ਗਾਇਕ ਇਸ ਦੀ ਵਰਤੋਂ ਕਰਦੇ ਹਨ ਅਤੇ ਕਿਹੜੇ ਨਹੀਂ ਕਿਉਂਕਿ ਇਹ ਇੱਕ ਆਮ ਤਕਨੀਕ ਹੈ ਜਿਹੜੇ ਕਿ ਬਹੁਤ ਸਾਰੇ ਗਾਇਕਾਂ ਦੁਆਰਾ ਵਰਤੀ ਜਾਂਦੀ ਹੈ

ਅਤੇ ਇਸ ਵਿੱਚ ਗਾਇਕ ਨੂੰ ਆਪਣੀ ਆਵਾਜ਼ ਸੁਰਾਂ ਅਤੇ ਸਾਹ 'ਤੇ ਪੂਰਾ ਜਿਹੜਾ ਕੰਟਰੋਲ ਰੱਖਣਾ ਪੈਂਦਾ ਆ ਦੂਜੇ ਪਾਸੇ ਜਿਹੜੀ ਕਿ ਆਟੋ ਟਿਊਨ ਗਾਇਕੀ ਹੁੰਦੀ ਆ ਉਹਨਾਂ ਵਿੱਚ ਗਾਇਕ ਨੂੰ ਆਪਣੀਆਂ ਜਿਹੜੀਆਂ ਆਵਾਜ਼ਾਂ ਦੀਆਂ ਕਮੀਆਂ ਨੂੰ ਛਪਾਉਣਾ ਪੈਂਦਾ ਆ ਸੂਰਾਂ ਨੂੰ ਸੁਧਾਰਨਾ ਕਰਨਾ ਸੁਧਾਰ ਕਰਨਾ ਪੈਂਦਾ ਆ ਠੀਕ ਆ ਮੇਰਾ ਮੰਨਣਾ ਹੈ ਕਿ ਜਿਹੜੀ ਦੋਵੇਂ ਤਰ੍ਹਾਂ ਦੀ ਗਾਇਕਾ ਗਾਇਕੀ ਆ ਜਿਹੜੀ ਉਹਨਾਂ ਦੀ ਥਾਂ ਆਪਣੀ ਆਪਣੀ ਆ ਲਾਈਵ ਗਾਇਕੀ ਦਾ ਇੱਕ ਵੱਖਰਾ ਹੀ ਰੋਮਾਨਚ ਜੋਸ਼ ਆ ਤੇ ਜੋ ਸੁਣਨ ਵਾਲਿਆਂ ਨੂੰ ਵੀ ਬਹੁਤ ਬਹੁਤ ਵਧੀਆ ਲੱਗਦਾ ਆ ਜਿਹੜੀ ਆਟੋ ਟਿਊਨ ਗਾਇਕ ਦੀ ਵਰਤੋਂ ਸੰਗੀਤ ਨੂੰ ਜਿਹੜੀ ਆ ਉਹ ਹੋਰ ਵੀ ਜ਼ਿਆਦਾ ਮਧੁਰ ਬਣਾਉਂਦੀ ਆ ਅਤੇ ਆਸਾਨ ਬਣਾਉਂਦੀ ਆ ਧੰਨਵਾਦ